ਹਾਂਜੀ ਅਸੀਂ ਆਪਣੇ ਨੇੜੇ ਦੇ ਹਸਪਤਾਲ ਵਿੱਚ ਬਹੁਤ ਹੀ ਮਤਲਬ ਭੀੜ ਦੇ ਮਤਲਬ ਬਹੁਤ ਹੀ ਭੀੜ ਦਾ ਸ਼ਿਕਾਰ ਹੁੰਦੇ ਹਾਂ ਅਸੀਂ ਬਹੁਤ ਹੀ ਮਤਲਬ ਚੁਨੌਤੀ ਦਾ ਵੱਡੀ ਦਾ ਸਾਹਮਣਾ ਕਰਦੇ ਹਾਂ ਜਿਹਦੇ ਕਰਕੇ ਜਿਹੜਾ ਕਿ ਸਾਨੂੰ ਬਹੁਤ ਸਾਰੀਆਂ ਮੁਸੀਬਤਾਂ ਦਾ ਸਾਹਮਣਾ ਕਰਨਾ ਪੈਂਦਾ ਕਈ ਵਾਰੀ ਇਹਦੇ ਨਤੀਜੇ ਵੀ ਬਹੁਤ ਮਾੜੇ ਨਿਕਲ ਆਉਂਦੇ ਸਨ ਜਿਵੇਂ ਕਿ ਸਾਡੇ ਨਾਲ ਦੇ ਪਿੰਡ ਘੁੱਦੇ ਜਿਹੜਾ ਹੈਗਾ ਸਰਕਾਰੀ ਹੋਸਪੀਟਲ ਇੱਥੇ ਬਹੁਤ ਹੀ ਜ਼ਿਆਦਾ ਮਤਲਬ ਭੀੜ ਹੁੰਦੀ ਹੈ ਜਿਹਦੇ ਨਾਲ ਕੀ ਹੈ ਕਿ ਇਹਦੇ ਵਿੱਚ ਮਰੀਜ਼ ਜਿਹੜੇ ਆ ਕੇ ਕਈ ਤਾਂ ਮਤਲਬ ਇਲਾਜ ਤੋਂ ਬਿਨਾਂ ਮਤਲਬ ਭੀੜ ਦੇ ਕਾਰਨ ਇਲਾਜ ਤੋਂ ਬਿਨਾਂ ਹੀ ਮਰ ਜਾਂਦੇ ਹਨ ਜਿਹਨਾਂ ਦੀ ਮੌਤ ਹੋ ਜਾਂਦੀ ਹੈ ਇਹਨਾਂ ਨੂੰ ਬਹੁਤ ਹੀ ਗਲਤ ਨਤੀਜੇ ਦਾ ਮਤਲਬ ਸਾਹਮਣਾ ਕਰਨਾ ਪੈਂਦਾ ਹੈ ਇਹਦੇ ਵਿੱਚ ਕੀ ਹੈ ਸਭ ਤੋਂ ਪਹਿਲਾਂ ਤਾਂ ਜਿਹੜਾ ਭੀੜ ਉੱਥੇ ਹੁੰਦੀ ਹੈ ਜਿੱਥੇ ਪਰਚੀ ਕਟਾਈ ਜਾਂਦੀ ਹੈ ਫਿਰ ਇਹਦੇ ਵਿੱਚ ਜਿਹੜਾ ਡਾਕਟਰ ਦੇ ਕੋਲ ਜਾਇਆ ਜਾਂਦਾ ਹੈ ਕੀ ਭੀੜਾਂ ਦੇ ਕਾਰਨ ਜ਼ਿਆਦੀ ਹਸਪਤਾਲ ਜਿਹੜੀ ਸ ਭੀੜ ਹੁੰਦੀ ਹੈ ਜ਼ਿਆਦੀ ਉਹ ਸਰਕਾਰੀ ਹਸਪਤਾਲਾਂ ਵਿੱਚ ਹੀ ਦੇਖੀ ਜਾਂਦੀ ਆ ਜਿਹਦੇ ਨਾਲ ਕੀ ਹੁੰਦਾ ਗਾ ਕੀ ਭੀੜ ਦੇ ਕਾਰਨ ਜਿਹੜਾ ਸਮਾਂ ਉਹ ਜ਼ਿਆਦਾ ਬਹੁਤ ਵਿਅਰਥ ਹੁੰਦਾ ਜਿਹਦੇ ਨਾਲ ਕੀ ਹੈ ਸਮੇਂ ਸਿਰ ਕਿਸੇ ਦਾ ਇਲਾਜ ਨਹੀਂ ਹੋ ਸਕਦਾ ਅਤੇ ਸਮੇਂ ਸਿਰ ਕੋਈ ਵੀ ਮਤਲਬ ਆਪਣਾ ਇਲਾਜ ਨਹੀਂ ਕਰਾ ਸਕਦਾ ਜਿਹਦੇ ਨਾਲ ਬਹੁਤ ਜ਼ਿਆਦੇ ਭੈੜੇ ਨਤੀਜਿਆਂ ਦਾ ਸਾਹਮਣਾ ਕਰਨਾ ਪੈਂਦਾ ਇਸ ਕਰਕੇ ਸਰਕਾਰ ਨੂੰ ਜਿਹੜਾ ਏ ਕਿ ਸਰਕਾਰੀ ਹੋਸਪੀਟਲ ਜ਼ਿਆਦਾ ਖੋਲ੍ਹਣੇ ਚਾਹੀਦੇ ਸਨ ਜਾਂ ਕੋਈ ਪ੍ਰਾਈਵੇਟ ਹੋਸਪੀਟਲਾਂ ਵਿੱਚ ਸੁਵਿਧਾ ਦੇਣੀ ਚਾਹੀਦੀ ਹੈ ਜਿਹਦੇ ਨਾਲ ਕੀ ਹੈ ਕਿ ਸਰਕਾਰੀ ਹੋਸਪੀਟਲ ਵੱਲੋਂ ਰੱਸ਼ ਘੱਟ ਕੇ ਘਟਾਇਆ ਜਾਵੇ ਅਤੇ ਜਿਹੜਾ ਕਿ ਲੋਕਾਂ ਨੂੰ ਸ ਮਤਲਬ ਸੁੱਖ ਸੁੱਖ ਸੁਵਿਧਾ ਦਿੱਤੀ ਜਾਵੇ ਜਿਹਦੇ ਨਾਲ ਕੀ ਹੈ ਕਿ ਲੋਕਾਂ ਦਾ ਸਹੀ ਸੈ ਟਾਈਮ ਸਿਰ ਇਲਾਜ ਹੋ ਸਕੇ ਅਤੇ ਲੋਕਾਂ ਨੂੰ ਮਤਲਬ ਭੈੜੇ ਨਤੀਜਿਆਂ ਦਾ ਸਾਹਮਣਾ ਨਾ ਕਰਨਾ ਪਵੇ